ਨਿਊਜ਼ ਮੀਡੀਆ ਦੇ ਬਦਲੇ ਪਲੇਟਫਾਰਮ ਸਭ ਤੋਂ ਪਹਿਲਾਂ ਅਖਬਾਰ ਦੇ ਮਾਧਿਅਮ ਰਾਹੀਂ ਅਸੀਂ ਖਬਰਾਂ ਪੜ੍ਹਦੇ ਸੀਗੇ ਤੇ ਹੌਲੀ ਹੌਲੀ ਫਿਰ ਰੇਡੀਓ ਦੇ ਮਾਧਵ ਰਾਹੀਂ ਅਸੀਂ ਖਬਰਾਂ ਪੜ੍ਹਨ ਸੁਣਨ ਲੱਗੇ ਤੇ ਫਿਰ ਇਸ ਤੋਂ ਬਾਅਦ ਐਂਟੀਨੇ ਵਾਲੇ ਟੀ ਵੀ ਆ ਗਏ ਜਿਸ ਤੋਂ ਸਾਨੂੰ ਖਬਰਾਂ ਦੇਖਣ ਨੂੰ ਤੇ ਸੁਣਨ ਨੂੰ ਮਿਲਦੀਆਂ ਰਹੀਆਂ ਫਿਰ ਉਸ ਤੋਂ ਬਾਅਦ ਨਵੀਂ ਟਕਨੀਕ ਆਈ ਤੇ ਜਿਸ ਨੇ ਕਿ ਪੂਰੀ ਦੁਨੀਆ ਦੇ ਵਿੱਚ ਖਬਰਾਂ ਸੁਣਨ ਦਾ ਪੜਨ ਦਾ ਤੇ ਦੇਖਣ ਦਾ ਨਜ਼ਰੀਆ ਬਦਲ ਦਿੱਤਾ ਜਿਸਨੂੰ ਅਸੀਂ ਇੰਟਰਨੈਟ ਕਹਿੰਣੇ ਆ ਧੰਨਵਾਦ